ਛੋਟੇ ਕਾਰੋਬਾਰ ਜਿਵੇਂ ਕਿ ਦੁੱਧ ਡਾਇਰੀ ਹੋ ਗਿਆ ਪਸ਼ੂ ਪਾਲਣ ਹੋ ਗਿਆ ਚੂਚੇ ਪਾਲਣ ਹੋ ਗਿਆ ਇਹ ਸਾਰੇ ਛੋਟੇ ਕਾਰੋਬਾਰ ਹੁੰਦੇ ਹਨ ਇਹਨਾਂ ਵਿੱਚ ਦਿਲਚਸਪੀ ਤੱਥ ਇਹ ਹੁੰਦੇ ਹਨ ਕਿ ਜਿਵੇਂ ਆਪਾਂ ਜਦੋਂ ਚੂਚਿਆਂ ਦੀ ਦੇਖ ਰੇਖ ਕਰਦੇ ਹਾਂ ਤਾਂ ਉਸ 'ਚ ਆਪਾਂ ਨੂੰ ਬਹੁਤ ਹੀ ਆਨੰਦ ਮਿਲਦਾ ਹੈ ਦੁੱਧ ਡਾਇਰੀ ਵੇਚਣ ਜਾਂਦੇ ਹਾਂ ਪਨੀਰ ਕੱਢਦੇ ਹਾਂ ਉਸ ਤੋਂ ਤਾਂ ਉਹ ਵੀ ਬਹੁਤ ਦਿਲਚਸਪ ਤੱਥ ਹੁੰਦੇ ਹਨ ਬੱਕਰੀ ਪਾਲਦੇ ਹਾਂ ਉਹ ਵੀ ਦਿਲਚਸਪੀ ਵਾਲੇ ਤੱਥ ਹਨ ਅਤੇ ਜਦੋਂ ਆਪਾਂ ਬੱਕਰੀ ਦਾ ਦੁੱਧ ਲੈਂਦੇ ਹਾਂ ਉਹ ਵੀ ਦਿਲਚਸਪੀ ਤੱਥ ਹੁੰਦੇ ਹਨ ਇਹ ਸਾਰੇ ਹੀ ਦਿਲਚਸਪੀ ਤੱਥ ਹਨ